ਮੈਂ ਬਾਗਬਾਨੀ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਬਾਗ ਮੈਂ ਇੱਕ ਕਿੱਲੇ ਦੇ ਵਿੱਚ ਬਾਗਬਾਨੀ ਸ਼ੁਰੂ ਕੀਤੀ ਹੈ ਉਸ ਵਿੱਚ ਇੱਕ ਸਾਈਡ 'ਤੇ ਪਾਪੂਲਰ ਦੇ ਬੂਟੇ ਲਗਾਏ ਹੋਏ ਹਨ ਅਤੇ ਇੱਕ ਸਾਈਡ 'ਤੇ ਮੈਂ ਸਬਜ਼ੀਆਂ ਬੀਜੀਆਂ ਹਨ ਅਤੇ ਉਸ ਵਿੱਚ ਸਬਜ਼ੀਆਂ ਜਿਵੇਂ ਕਿ ਮੈਂ ਆਲੂ ਗੋਭੀ ਸ਼ਲਗਮ ਮੂਲੀ ਆਦਿ ਬੀਜੇ ਹੋਏ ਹਨ ਅਤੇ ਇੱਕ ਸਾਈਡ 'ਤੇ ਮੈਂ ਫਲ ਵੀ ਬੀਜੇ ਹਨ ਜਿਵੇਂ ਕਿ ਸੇਬ ਕੇਲੇ ਅਤੇ ਅੰਗੂਰ ਅਤੇ ਇਸ ਤੋਂ ਮੈਨੂੰ ਬਹੁਤ ਹੀ ਲਾਭ ਹੋ ਰਿਹਾ ਹੈ ਅਤੇ ਮੈਂ ਇਹ ਇਹ ਸਭ ਉਸ ਆਪਣੇ ਦੋਸਤ ਤੋਂ ਦੋਸਤ ਤੋਂ ਸਿੱਖਿਆ ਹੈ ਅਤੇ ਉਸ ਨੇ ਉਹ ਉਸ ਨੇ ਬਾਗਬਾਨੀ ਬਾਰੇ ਮੈਨੂੰ ਦੱਸਿਆ ਅਤੇ ਇਸ ਬਾ ਬਾਗਵਾਨੀ ਤੋਂ ਮੈਨੂੰ ਬਹੁਤ ਹੀ ਲਾਭ ਹੋ ਰਿਹਾ ਹੈ ਅਤੇ ਇਸ ਨੂੰ ਮੈਂ ਦੋ ਚਾਰ ਸਾਲ ਹੋ ਗਏ ਸ਼ੁਰੂ ਕੀਤੇ ਨੂੰ ਅਤੇ ਅਤੇ ਇਸ ਇਸ ਵਿੱਚ ਤਾਜ਼ੀਆਂ ਸਬਜ਼ੀਆਂ ਮੰਡੀਆਂ ਵਿੱਚ ਵੀ ਭੇਜੀਆਂ ਜਾ ਰਹੀਆਂ ਹਨ ਅਤੇ ਅਤੇ ਉਸ ਉਸ ਇਸ ਤੋਂ ਮੈਨੂੰ ਬਹੁਤ ਹੀ ਲਾਭ ਹੋ ਰਿਹਾ